ਅੱਜ ਕੱਲ੍ਹ ਮੈਂ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਚਿੱਤਰ ਦੇਖੇ ਆ ਆਪਣੇ ਵਿਹਲੇ ਟਾਇਮ ਦੇ ਵਿੱਚ ਅਤੇ ਕੁਸ਼ ਕੁ ਚਿੱਤਰ ਟਾਈਮਪਾਸ ਵਾਲੇ ਹੁੰਦੇ ਅਤੇ ਕੁਸ਼ ਕੁ ਚਿੱਤਰਾਂ ਦੇ ਵਿੱਚ ਲੋਕ ਬੜੇ ਅਲੱਗ ਅਲੱਗ ਸਿੱਖ ਸਕਦੇ ਹਾਂ ਅ ਮੈਨੂੰ ਯਾਦ ਆ ਇੱਕ ਦਿਨ ਮੈਂ ਇੱਕ ਚਿੱਤਰ ਦੇਖਿਆ ਮੈਂ ਲੁਧਿਆਣਾ ਬੀ ਐੱਮ ਮੋਲ ਦੇ ਵਿੱਚ ਗਿਆ ਅਤੇ ਉੱਥੇ ਇੱਕ ਚਿੱਤਰ ਲੱਗਿਆ ਸੀਗਾ ਐਂਟੀ ਗੇਟ ਦੇ ਉੱਪਰ ਉੱਥੇ ਸੇਲੈਂਟ ਚਿੱਤਰ ਨੂੰ ਦੇਖਿਆ ਅਤੇ ਉੱਥੇ ਸੇਲੈਂਟ ਜਿਹੀ ਪਿੱਚਰ ਸੀਗੀ ਅਤੇ ਮੈਂ ਚਿੱਤਰ ਨੂੰ ਦੇਖਿਆ ਅਤੇ ਮੇਰਾ ਮਾਇਡ ਫਰੈਸ਼ ਹੋ ਗਿਆ ਉੱਥੇ ਇੱਕ ਬੰਦਾ ਬਣਿਆ ਸੀਗਾ ਕਿਹੜਾ ਹੱਥ ਵਿੱਚ ਸਿਗਰਟ ਲਈ ਖੜ੍ਹਾ ਸੀਗਾ ਅਤੇ ਜਦੋਂ ਉਹਨੂੰ ਦੇਖਿਆ ਤਾਂ ਉਹ ਬਹੁਤ ਅਲੱਗ ਅਲੱਗ ਸਮਾਂ ਬਿਮਾਰੀ ਤੋਂ ਲੰਘ ਰਿਹਾ ਸੀਗਾ ਅਤੇ ਪਹਿਲਾਂ ਮੈਂ ਉਹ ਚਿੱਤਰ ਨੂੰ ਦੇਖ ਕੇ ਉਹਦਾ ਸੈਂਟਰ ਆਈਡੀਆ ਕਰ ਲਿਆ ਅਤੇ ਮੈਂ ਆਪਣੇ ਦੋਸਤ ਨੂੰ ਵੀ ਦੱਸਿਆ ਕਿ ਇਹ ਚਿੱਤਰ ਬਹੁਤ ਵਧੀਆ ਹੈ ਅਤੇ ਉਸ ਤੋਂ ਬਾਚੋਂ ਮੈਂ ਚਿੱਤਰ ਨੂੰ ਪੂਰਾ ਸਮਝਿਆ ਅਤੇ ਉੱਥੇ ਮੈਨੂੰ ਚਿੱਤਰ ਦੇ ਵਿੱਚ ਇੰਟਰਸਟ ਵੀ ਆਇਆ ਅਤੇ ਮੈਂ ਵੀ ਅਲੱਗ ਅਲੱਗ ਤਰੀਕੇ ਦੇ ਡਰਾਇੰਗਾਂ ਬਣਾਈਆਂ ਆਪਣੇ ਘਰ ਆ ਕੇ ਅਤੇ ਚਿੱਤਰ ਰਾਜਕੁਮਾਰ ਨੇ ਬਣਾਏ ਸੀਗਾ ਕਿਰਨ ਲੁਧਿਆਣੇ ਦਾ ਮਸ਼ਹੂਰ ਆਰਟਿਸਟ ਆਰਟਿਸਟ ਸੀਗਾ ਅਤੇ ਪਿੰਡ ਓ 'ਚ ਆਰਟਿਸਟ ਸੀਗਾ ਅਤੇ ਅਲੱਗ ਅਲੱਗ ਤਰ੍ਹਾਂ ਦੇ ਚਿੱਤਰ ਬਣਾਉਂਦਾ ਸੀਗਾ ਉਸ ਤੋਂ ਬਾਅਦ ਜੋ ਮੈਂ ਉਹਦਾ ਇੰਸਟਾਗ੍ਰਾਮ 'ਤੇ ਪੇਜ ਵੀ ਸਰਚ ਕੀਤਾ ਪੇਜ ਸਰਚ ਕਰਨ ਤੋਂ ਬਾਚੋਂ ਮੈਨੂੰ ਪਤਾ ਲੱਗਿਆ ਉਹ ਬਹੁਤ ਫੇਮਸ ਆਰਟਿਸਟ ਹੈ ਅਤੇ ਉਹਨੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਚਿੱਤਰ ਬਣਾਏ ਹੈ ਕਿੱਦਾਂ ਡੀਪ ਆਈਡੀਆ ਹੋਵੇ ਅਤੇ ਉਹਦੇ ਅਲੱਗ ਅਲੱਗ ਤਰ੍ਹਾਂ ਦੀਆਂ ਪੋਸਟਾਂ ਦੇਖ ਕੇ ਮੈਂ ਬਹੁਤ ਚੀਜ਼ਾਂ ਯਾਦ ਕੀਤੀਆਂ ਅਤੇ ਮੈਂ ਉਹ ਅਕਸਰ ਵੀਡੀਓ ਪਾਉਂਦਾ ਸੀਗਾ ਆਪਣੀ ਚਿੱਤਰ ਕਿਵੇਂ ਉਹ ਡਰਾਇੰਗਾਂ ਬਣਾਉਂਦਾ ਸੀਗਾ ਅਤੇ ਉਸ ਤੋਂ ਬਾਅਦ 'ਚੋਂ ਮੈਂ ਵੀ ਉਹਦਾ ਤਰੀਕਾ ਫੋਲੋ ਕਰਨ ਲੱਗਿਆਂ ਅਤੇ ਮੈਨੂੰ ਉਹ ਵੀ ਪਤਾ ਲੱਗਿਆ ਕਿ ਉਹ ਬਹੁਤ ਮਸ਼ਹੂਰ ਆਰਟਿਸਟ ਹੈ ਅਤੇ ਉਹਨੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਚਿੱਤਰ ਬਣਾਏ ਹੋਏ ਆ ਅਤੇ ਇੱਕ ਵਾਰ ਉਹਨੇ ਕੋਵਿਡ ਦੇ ਵਿੱਚ ਵੀ ਇੱਕ ਇਹੋ ਜਿਹਾ ਚਿੱਤਰ ਬਣਾਇਆ ਸੀਗਾ ਕਿ ਵਿੱਚ ਸੋਸ਼ਲ ਡਿਸਟੈਂਸ ਸੀਗਾ ਪੂਰਾ ਬਣਾਇਆ ਹੋਇਆ ਅਤੇ ਉਹਨੂੰ ਸਰਕਾਰ ਵੱਲੋਂ ਬਹੁਤ ਅਵਾਰਡ ਵੀ ਮਿਲੇ ਸੀਗੇ ਚਿੱਤਰ ਬਾਰੇ ਕਿਉਂਕਿ ਬਹੁਤ ਲੋਕਾਂ ਨੇ ਉਹ ਚਿੱਤਰ ਨੂੰ ਲਾਈਕ ਕੀਤਾ ਸੀਗਾ ਅਤੇ ਉਹ ਓ ਸੇਫ ਰੂਲ ਫੋਲੋ ਕਰਦੇ ਸੀਗੇ ਆਪਣੀ ਜ਼ਿੰਦਗੀ ਦੇ ਵਿੱਚ ਅਤੇ ਚਿੱਤਰਾਂ ਦੇ ਚਿੱਤਰਾਂ ਨਾਲ ਬਣਾ ਬਣਾ ਕੇ ਆਪਾਂ ਆਪਣੀ ਫੀਲਿੰਗਾਂ ਐਕਸਪ੍ਰੈਸ ਕਰ ਸਕਦੇ ਹਾਂ ਚਿੱਤਰ ਬਣਾ ਕੇ ਆਪਾਂ ਫਿਲਿੰਗ ਐਕਸਪ੍ਰੈਸ ਕਰ ਸਕਦੇ ਹਾਂ ਅਤੇ ਇਹ ਬਹੁਤ ਇੱਕ ਵਧੀਆ ਲੇਜ਼ਰ ਐਕਟੀਵਿਟੀ ਆ ਕਿਉਂਕਿ ਕਦੋਂ ਵੀ ਆਪਣੇ ਕੋਲ ਫਰੀ ਸਮਾਂ ਹੋਵੇ ਆਪਾਂ ਮੋਬਾਈਲ ਜਗ੍ਹਾ ਚਿੱਤਰ ਬਣਾ ਸਕਦੇ ਹਾਂ ਕਿਹਦੇ ਕਾਰਨ ਆਪਾਂ ਅਲੱਗ ਅਲੱਗ ਚੀਜ਼ਾਂ ਬਣਾ ਕੇ ਮਸ਼ਹੂਰ ਹੋ ਮਸ਼ਹੂਰ ਵੀ ਹੋ ਸਕਦੇ ਹਾਂ ਅਤੇ ਆਈ ਜਿਹੀ ਚਿੱਤਰ ਬਣਾ ਕੇ ਲੋਕ ਅਰਾਮ ਨਾਲ ਸਕਸੈਸ ਗੇਨ ਕਰ ਲੈਂਦੇ ਆ